ਭਾਂਡੇ ਧੋਣਾ ਵੀ ਆਪਣੇ ਆਪ 'ਚ ਇੱਕ ਕਲਾ ਹੈ ਘਰ 'ਚ ਬਥੇਰੇ ਇਹੋ ਜਿਹੇ ਬਰਤਨ ਹੁੰਦੇ ਹਨ ਜਿਹੜੇ ਅਸੀਂ ਖਾਣ ਵਿੱਚ ਵੀ ਯੂਜ ਕਰਦੇ ਹਨ ਅਤੇ ਖਾਣਾ ਬਣਾਉਣ 'ਚ ਵੀ ਯੂਜ ਕਰਦੇ ਹਨ ਮਿੱਟੀ ਦੇ ਬਰਤਨ ਹੋ ਗਏ ਕੱਚ ਦੇ ਹੋ ਗਏ ਭਾਵੇਂ ਸਟੀਲ ਦੇ ਹੋ ਜਾਣ ਇਹ ਸਾਰੇ ਬ ਬਰਤਨ ਅਸੀਂ ਯੂਜ ਕਰਦੇ ਹਨ ਅਤੇ ਅਸੀਂ ਇਹਨਾਂ ਨੂੰ ਧੋ ਧੋਂਦੇ ਵੀ ਹਨ ਅਤੇ ਇਨ ਇਹਨਾਂ ਦੋਨਾਂ ਬਰਤਨਾਂ ਨੂੰ ਧੋਣ ਵਿੱਚ ਵੀ ਕਾਫੀ ਜ਼ਿਆਦਾ ਮਿਹਨਤ ਵੀ ਲੱਗਦੀ ਹੈ ਅਤੇ ਧਿਆਨ ਵੀ ਰੱਖਣਾ ਪੈਂਦਾ ਹੈ ਕੱਚ ਦੇ ਬਰਤਨ ਹੋ ਗਏ ਹੋ ਜਾਣ ਅਤੇ ਮਿੱਟੀ ਦੇ ਬਰਤਨ ਹੋਣ ਇਹਨਾਂ ਨੂੰ ਅਸੀਂ ਸਾਂਭ ਕੇ ਧੋਂਦੇ ਹਨ ਤਾਂ ਕਿ ਇਹ ਟੁੱਟ ਨਾ ਜਾਣ ਕਿਉਂਕਿ ਇਹ ਡਲੀਕੇਟ ਵੀ ਹੁੰਦੇ ਹਨ ਅਤੇ ਜਿਹੜੇ ਮਿੱਟੀ ਦੇ ਬਰਤਨ ਹੋ ਗਏ ਜਾਂ ਫਿਰ ਅਸੀਂ ਸਟੀਲ ਦੇ ਬਰਤਨ ਹੋ ਗਏ ਇਹਨਾਂ ਨੂੰ ਅਸੀਂ ਧੋਂਦੇ ਵੀ ਹਨ ਅਤੇ ਸੁਕਾਉਂਦੇ ਵੀ ਹਨ ਸਟੀਲ ਦੇ ਬਰਤਨ ਜਿਹੜੇ ਬਣਾਉਣ ਵਿੱਚ ਯੂਜ਼ ਹੁੰਦੇ ਹਨ ਉਹਨਾਂ ਉਹ ਉਹ ਵਾਲੇ ਉਹਨਾਂ ਨੂੰ ਧੋਣ ਵਿੱਚ ਵੀ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਉਰ ਉਹਨਾਂ 'ਚ ਅਸੀਂ ਜ਼ਰਾ ਸਾਬਣ ਵੀ ਵਰਤਦੇ ਹਨ ਅਤੇ ਮਿੱਟੀ ਵੀ ੳ ਯੂਜ਼ ਹੁੰਦੀ ਹਨ ਜਿਹੜੇ ਬਰਤਨ ਨੂੰ ਅਸੀਂ ਖਾਣ ਵਿੱਚ ਯੂਜ ਕਰਦੇ ਹਨ ਖਾਣ ਅਤੇ ਖਾਣਾ ਬਣਾਉਣ ਵਿੱਚ ਯੂਜ ਕਰਦੇ ਹਨ ਉਹਨਾਂ 'ਚ ਸਾਨੂੰ ਬਹੁਤ ਤੇਲ ਵਾਲੇ ਬ ਬਰਤਨ ਹੁੰਦੇ ਹਨ ਉਹ ਅਸੀਂ ਰਗੜ ਕੇ ਜ਼ਿਆਦਾ ਸਾਬਣ ਨਾਲ ਅਤੇ ਮਿੱਟੀ ਨਾਲ ਉਹਨਾਂ ਨੂੰ ਅਸੀਂ ਧੋਂਦੇ ਹਨ ਅਸੀਂ ਘਰ ਦੇ ਜਿ ਜਿੰਨੇ ਵੀ ਮੈਂਬਰਸ ਹੋ ਗਏ ਭਾਵੇਂ ਉਹ ਬੱਚੇ ਹੋਣ ਮੰਮੀ ਹੋਣ ਪਾਪਾ ਹੋਣ ਅਤੇ ਬਜ਼ੁਰਗ ਹਨ ਇਹ ਸਾਰੇ ਬਰਤਨ ਸਾਰਿਆਂ ਨੂੰ ਧੋਣੇ ਚਾਹੀਦੇ ਹਨ